ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ੍ਹ ਸਾਹਿਬ ਵਿਖੇ ਜੋ ਸਭ ਤੋਂ ਵੱਡਾ ਸਥਾਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਯਾਦ ਦੇ ਵਿੱਚ ਬਣਿਆ ਹੋਇਆ ਹੈ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਅਤੇ ਮਾਤਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਜੋ ਧਰਮ ਦੀ ਆਨ ਬਾਨ ਸ਼ਾਨ ਨੂੰ ਬਚਾਉਂਦੇ ਹੋਏ ਇਸਨੂੰ ਹੋਰ ਵੀ ਉੱਚਾ ਕੀਤਾ ਅਤੇ ਜਾਲਮ ਮੁਗਲਾਂ ਅੱਗੇ ਹਾਰੇ ਨਹੀਂ ਅਤੇ ਜਿੱਤ ਪ੍ਰਾਪਤ ਕੀਤੀ ਜਿਸ ਕਰਕੇ ਇਸ ਜ਼ਿਲ੍ਹੇ ਦਾ ਨਾਂ ਫਤਿਹਗੜ੍ਹ ਸਾਹਿਬ ਕਰਕੇ ਵੀ ਜਾਣਿਆ ਜਾਂਦਾ ਹੈ ਸੋ ਉਹਨਾਂ ਦੀ ਸ਼ਹਾਦਤ ਦੇ ਦਿਨਾਂ ਨੂੰ ਯਾਦ ਕਰਦਿਆਂ ਹਰ ਸਾਲ ਲਗਭਗ ਇੱਕ ਪੰਦਰਵਾੜਾ ਮਨਾਇਆ ਜਾਂਦਾ ਹੈ ਅਤੇ ਉਸਦੀ ਸਿਖਰ ਜੋ ਅਖੀਰਲੇ ਤਿੰਨ ਦਿਨ ਹੁੰਦੇ ਹਨ ਖਾਸ ਤੌਰ 'ਤੇ ਪੱਚੀ ਛੱਬੀ ਸਤਾਈ ਦਸੰਬਰ ਦੇ ਲਗਭਗ ਉਹ ਦਿਨ ਆਉਂਦੇ ਨੇ ਅਤੇ ਉਹਨਾਂ ਦਿਨਾਂ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਇਸ ਅਸਥਾਨ 'ਤੇ ਨਤਮਸਤਕ ਹੁੰਦੀਆਂ ਨੇ ਔਰ ਬਹੁਤ ਵੱਡੀ ਗਿਣਤੀ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਆ ਕੇ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸੰਗਤ ਲੰਗਰ ਦੀ ਸੇਵਾਵਾਂ ਚਲਾਉਂਦੀਆਂ ਨੇ ਅਤੇ ਇਹ ਸੇਵਾ ਦਾ ਕਾਰਜ ਲਗਭਗ ਦਸ ਤੋਂ ਪੰਦਰ੍ਹਾਂ ਦਿਨ ਚੱਲਦਾ ਹੀ ਰਹਿੰਦਾ ਹੈ ਅਤੇ ਤਿੰਨ ਤੋਂ ਚਾਰ ਦਿਨ ਤਾਂ ਬਹੁਤ ਹੀ ਡੂੰਘੇ ਤਰੀਕੇ ਨਾਲ ਇਹ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਨੌਜਵਾਨਾਂ ਦੁਆਰਾ ਬਜ਼ੁਰਗਾਂ ਦੁਆਰਾ ਮਾਈਆਂ ਭਾਈਆਂ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ